ਜਿਹੜੇ ਹੈਂਡਮੇਡ ਕਲੋਥ ਨੇ ਅਤੇ ਮਤਲਬ ਕਿ ਜਿਹੜੇ ਰੈਡੀਮੇਡ ਕਲੋਥ ਨੇ ਉਹਨਾਂ ਦੇ ਵਿੱਚੋਂ ਫ਼ਰਕ ਤਾਂ ਜਮੀਨ ਅਸਮਾਨ ਦਾ ਹੀ ਹੈ ਜਿੱਥੇ ਕੀ ਆਪਾਂ ਰੈਡੀਮੇਡ ਕਲੋਥ ਦੇਖਦੇ ਹਾਂ ਅਤੇ ਉਹਨਾਂ ਦੇ ਸਟਾਫਿੰਗ ਦਾ ਅਤੇ ਉਹਨਾਂ ਦੀ ਸਟੀਚਿੰਗ ਜਿਵੇਂ ਆਪਾਂ ਸਪੈਸ਼ਲੀ ਅਗਰ ਆਪਾਂ ਸਟੀਚਿੰਗ ਦੇਖੀਏ ਤਾਂ ਉਹ ਸਟੀਚਿੰਗ ਕੀ ਹੈ ਬਹੁਤ ਰਫ ਢੰਗ ਨਾਲ ਕੀਤੀ ਹੁੰਦੀ ਹੈ ਮਤਲਵ ਪੱਕੀ ਸਿਉਣਾ ਨਹੀਂ ਹੁੰਦੀਆਂ ਅਤੇ ਜਿੱਥੇ ਆਪਾਂ ਮਤਲਬ ਕਿ ਘਰੇ ਮਤਲਬ ਜਿਹੜੇ ਆਪਾਂ ਕਲੋਥ ਰੈਡੀ ਕਰਦੇ ਹਾਂ ਮਤਲਬ ਹ ਹੱਥੀ ਬਣਾਉਂਦੇ ਹਾਂ ਤਾਂ ਉਹ ਕੱਪੜਿਆਂ ਦੀ ਮਤਲਬ ਉਹ ਕੱਪੜਿਆਂ ਦੀ ਜਿਹੜੀਆਂ ਸਿਊਣਾ ਵੀ ਆਪਾਂ ਪੱਕੇ ਢੰਗ ਨਾਲ ਲਗਾਉਂਦੇ ਹਾਂ ਅਤੇ ਮਤਲਬ ਇੱਕ ਸਾਫ਼ ਸੁਥਰੇ ਢੰਗ ਨਾਲ ਬਣਦੇ ਹੈ ਅਤੇ ਜਿਹੜੇ ਰੈਡੀਮੇਡ ਕੱਪੜੇ ਕੱਪੜੇ ਹੁੰਦੇ ਆਪਾਂ ਅਕਸਰ ਦੇਖਦੇ ਹਾਂ ਕਿ ਇੱਕ ਮਤਲਬ ਅਜੀਬ ਜਿਹੀ ਉਹਨਾਂ ਦੇ ਵਿੱਚੋਂ ਮੈਨੂੰ ਸਮੈੱਲ ਆਉਂਦੀ ਹੁੰਦੀ ਹੈ ਅਤੇ ਕੀ ਹੈ ਜਿਹੜੇ ਮਤਲਬ ਆਪਾਂ ਘਰੇ ਬਣਾਉਂਦੇ ਹਾਂ ਕੱਪੜੇ ਉਹ ਕੀ ਆ ਬ ਬੜੇ ਵਧੀਆ ਮਤਲਬ ਆਪਾਂ ਸਾਫ਼ ਸੁਥਰੇ ਢੰਗ ਨਾਲ ਬਣਾਉਂਦੇ ਹਾਂ ਇੱਕ ਪ੍ਰੋਪਰ ਕੱਪੜਾ ਆਪਣੀ ਆਪਣੀ ਚੋਆਇਸ ਦਾ ਦੇਖਦੇ ਕੇ ਲੈਂਦੇ ਹਾਂ ਅਤੇ ਆਪਣੀ ਚੋਆਇਸ ਨਾਲ ਆਪਾਂ ਉ ਉਹਨੂੰ ਤਿਆਰ ਕਰ ਸਕਦੇ ਹਾਂ